ਮੈਂ ਦਿਕਸ਼ਾ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੇਕਰ ਮੈਨੂੰ ਕਦੇ ਭਵਿੱਖ ਵਿੱਚ ਯਾਤਰਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਸਭ ਤੋਂ ਪਹਿਲਾਂ ਇੰਡੀਆ ਦੀ ਯਾਨੀ ਕਿ ਭਾਰਤ ਦੀ ਹੀ ਯਾਤਰਾ ਕਰਨਾ ਚਾਹੁੰਦੀ ਹਾਂ ਕਿਉਂਕਿ ਸਾਡਾ ਭਾਰਤ ਦੇਸ਼ ਪਹਿਲੇ ਸਮੇਂ ਤੋਂ ਅੱਜ ਤੱਕ ਬਹੁਤ ਜ਼ਿਆਦਾ ਵਿਕਸਿਤ ਹੋ ਗਿਆ ਹੈ ਜਿਵੇਂ ਕਿ ਸਾਡੇ ਬਜ਼ੁਰਗ ਦੱਸਦੇ ਸਨ ਕਿ ਪਹਿਲੇ ਸਮੇਂ ਵਿੱਚ ਸਾਧਨ ਨਹੀਂ ਹੁੰਦੇ ਸਨ ਲੋਕ ਹਜ਼ਾਰਾਂ ਮੀਲਾਂ ਦੀਆਂ ਯਾਤਰਾ ਪੈਦਲ ਹੀ ਤੈਅ ਕਰਦੇ ਸਨ ਅਤੇ ਅੱਜ ਦੇ ਟਾਈਮ ਵਿੱਚ ਸਾਡਾ ਭਾਰਤ ਦੇਸ਼ ਬਹੁਤ ਹੀ ਤਰੱਕੀ ਕਰ ਚੁੱਕਿਆ ਹੈ ਅਤੇ ਸਾਡੇ ਭਾਰਤ ਵਿੱਚ ਬਹੁਤ ਸਾਰੀਆਂ ਜਗ੍ਹਾ ਹਨ ਜੋ ਕਿ ਦੇਖਣ ਯੋਗ ਹਨ ਇਸ ਕਰਕੇ ਮੈਂ ਭਵਿੱਖ ਦੀ ਯਾਤਰਾ ਜੋ ਵੀ ਹੋਵੇਗੀ ਉਹ ਭਾਰਤ ਦੇਸ਼ ਵਿੱਚ ਹੀ ਕਰਨਾ ਚਾਹੁੰਦੀ ਹਾਂ ਅਤੇ ਟੈਕਨੋਲੋਜੀ ਨਾਲ ਵੀ ਸਾਡਾ ਭਾਰਤ ਬਹੁਤ ਜ਼ਿਆਦਾ ਵਿਕਸਿਤ ਹੋ ਗਿਆ ਹੈ ਜਿਵੇਂ ਪਹਿਲੇ ਲੋਕ ਹਜ਼ਾਰਾਂ ਮੀਲਾਂ ਦੀਆਂ ਯਾਤਰਾ ਪੈਦਲ ਹੀ ਤੈਅ ਕਰਦੇ ਸਨ ਅਤੇ ਸਾਡੇ ਬਜ਼ੁਰਗ ਇਹ ਵੀ ਦੱਸਦੇ ਸਨ ਕਿ ਅਗਰ ਕਿਸੇ ਦੇ ਘਰ ਮੌਤ ਹੋ ਜਾਂਦੀ ਸੀ ਅਤੇ ਉਹ ਉਸ ਦੇ ਫੁੱਲ ਨਹੀਂ ਤਾਰਨ ਜਾ ਸਕਦਾ ਸੀ ਤਾਂ ਉਹ ਕਈ ਦਿਨਾਂ ਤੱਕ ਉਸ ਦੇ ਜਿਹੜੇ ਫੁੱਲ ਸੀ ਉਹ ਆਪਣੇ ਘਰ ਹੀ ਰੱਖ ਰਹਿੰਦਾ ਸੀ ਅਤੇ ਜਦੋਂ ਕੋਈ ਪਿੰਡ ਵਿੱਚੋਂ ਦੂਸਰਾ ਜਾਂਦਾ ਸੀ ਅਤੇ ਉਹਦੇ ਹੱਥ ਉਹ ਭੇਜ ਦਿੱਤੇ ਜਾਂਦੇ ਸਨ ਅਤੇ ਟੈਕਨੋਲਜੀ ਨੇ ਹੁਣ ਬਹੁਤ ਤਰੱਕੀ ਕਰ ਲਈ ਜਿਵੇਂ ਕਿ ਆਨਲਾਈਨ ਸਿਸਟਮ ਹੋ ਗਿਆ ਮੋਬਾਇਲਸ ਆ ਗਏ ਕੰਪਿਊਟਰ ਆ ਗਿਆ ਪਹਿਲੇ ਲੋਕ ਡਾਕ ਪਾਉਂਦੇ ਸਨ ਹੁਣ ਲੋਕ ਈਮੇਲ ਕਰ ਦਿੰਦੇ ਆ ਜਾਂ ਮੈਸੇਜ ਕਰ ਦਿੰਦੇ ਆ ਇਸ ਤਰ੍ਹਾਂ ਟੈਕਨੋਲੋਜੀ ਨਾਲ ਬਹੁਤ ਜ਼ਿਆਦਾ ਭਾਰਤ ਦੇਸ਼ ਵਿਕਸਿਤ ਹੋ ਰਿਹਾ ਹੈ ਅਤੇ ਮੈਂ ਜਿਹੜੀ ਹੈ ਆਪਣੀ ਭਵਿੱਖ ਯਾਤਰਾ ਭਾਰਤ ਵਿੱਚ ਹੀ ਕਰਨਾ ਚਾਹੁੰਦੀ ਹਾਂ ਧੰਨਵਾਦ